ਜੇ ਆਪਾਂ ਬ੍ਰਿਟਿਸ਼ ਸ਼ਾਸਨ ਤੋਂ ਲੈ ਕੇ ਭਾਰਤ ਦੀ ਆਜ਼ਾਦੀ ਤੱਕ ਦੀ ਗੱਲ ਕਰੀਏ ਤਾਂ ਪੰਜਾਬ ਭਾਰਤ ਦੇ ਸਾਰੇ ਰਾਜਾਂ ਤੋਂ ਵੱਧ ਸਭ ਤੋਂ ਵੱਧ ਯੋਗਦਾਨ ਆਪਾਂ ਪੰਜਾਬ ਦਾ ਮੰਨ ਕੇ ਚੱਲਦੇ ਹਾਂ ਪੰਜਾਬ ਦੇ ਵਿੱਚ ਅਗਰ ਆਪਾਂ ਗੱਲ ਕਰੀਏ ਭਾਰਤ ਦੀ ਆਜ਼ਾਦੀ ਲਈ ਕਰਤਾਰ ਸਿੰਘ ਸਰਾਭਾ ਹੋ ਗਿਆ ਭਗਤ ਸਿੰਘ ਹੋ ਗਿਆ ਲਾਲਾ ਲਾਜਪਤ ਰਾਏ ਹੋ ਗਿਆ ਅਤੇ ਉਸ ਤੋਂ ਬਾਅਦ ਮੁੱਖ ਘਟਨਾਵਾਂ ਜੇਕਰ ਆਪਾਂ ਗੱਲ ਕਰ ਲਈਏ ਤਾਂ ਜਲਿਆਂਵਾਲਾ ਬਾਗ ਹੋ ਗਿਆ ਅਤੇ ਆਪਾਂ ਆਪਾਂ ਇਹ ਵੀ ਸੁਣਦੇ ਹਾਂ ਕਿ ਲਾਲਾ ਲਾਜਪਤ ਰਾਏ ਜੀ ਨੂੰ ਸ਼ੇਰੇ ਪੰਜਾਬ ਕਿਹਾ ਜਾਂਦਾ ਸੀਗਾ ਉਹਨਾਂ ਦਾ ਜਿਹੜਾ ਦੇਹਾਂਤ ਹੈ ਉਹ ਬ੍ਰਿਟਿਕਸ਼ ਬ੍ਰਿਟਿਸ਼ ਸ਼ਾਸਨਾਂ ਦੇ ਵਿਰੋਧ ਦੇ ਵਿੱਚ ਹੀ ਹੋਇਆ ਸੀਗਾ ਅਤੇ ਉਸ ਤੋਂ ਬਾਅਦ ਆਪਾਂ ਗੱਲ ਕਰੀਏ ਤਾਂ ਜਿਹਨੂੰ ਭਗਤ ਸਿੰਘ ਸੁਖਦੇਵ ਰਾਜਗੁਰੂ ਇਹ ਇਹ ਵੀ ਇੱਕ ਮੰਨੇ ਹੋਏ ਜਾਂ ਆਪਣੇ ਪੰਜਾਬ ਦੀ ਆਜ਼ਾਦੀ ਲਈ ਜਾਂ ਭਾਰਤ ਦੀ ਆਜ਼ਾਦੀ ਲਈ ਮੰਨੇ ਗਏ ਹਨ ਇਹਨਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ ਭਾਰਤ ਦੀ ਆਜ਼ਾਦੀ ਦੇ ਲਈ ਇਹ ਕੁਰਬਾਨੀ ਦਿੱਤੀ ਉਸ ਤੋਂ ਇਲਾਵਾ ਆਪਾਂ ਗੱਲ ਕਰੀਏ ਕਾਮਾਗਾਟਾਮਾਰੂ ਇੰਸੀਡੈਂਟ ਹੋ ਗਿਆ ਜੇਕਰ ਅਤੇ ਉਸ ਤੋਂ ਬਾਅਦ ਜਿਹੜਾ ਕਰਤਾਰ ਸਿੰਘ ਸਰਾਭਾ ਨੇ ਜਿਹੜੀ ਪਾਰਟੀ ਬਣਾਈ ਉੱਨੀ ਸੌ ਗਿਆਰ੍ਹਾਂ ਦੇ ਵਿੱਚ ਗਦਰ ਪਾਰਟੀ ਉਹ ਵੀ ਇੱਕ ਤਰ੍ਹਾਂ ਦੀ ਬਾਹਰ ਜਾ ਕੇ ਪੰਜਾਬ ਯੂ ਐਸ ਏ ਦੇ ਵਿੱਚ ਜਾ ਕੇ ਕਨੇਡਾ ਦੇ ਵਿੱਚ ਜਾ ਕੇ ਪੰਜਾਬੀਆਂ ਨੂੰ ਪ੍ਰੇਰਿਤ ਕਰਨਾ ਕਿ ਆਓ ਜਿਹੜੇ ਬਾਹਰ ਜਾ ਚੁੱਕੇ ਨੇ ਉਹ ਭਾਰਤ ਵਿੱਚ ਆਓ ਅਤੇ ਆਪਾਂ ਭਾਰਤ ਦੀ ਆਜ਼ਾਦੀ ਦੇ ਲਈ ਲੜੀਏ ਠੀਕ ਹੈ ਉਸ ਤੋਂ ਇਲਾਵਾ ਜਿਹੜਾ ਜਲਿਆਂਵਾਲਾ ਬਾਗ ਸੀ ਉੱਥੇ ਉੱਥੇ ਵੀ ਜਿਹੜਾ ਇਕੱਠ ਹੋਇਆ ਉਹ ਵੀ ਭਾਰਤ ਦੀ ਆਜ਼ਾਦੀ ਨੂੰ ਲੈ ਕੇ ਹੀ ਹੋਇਆ ਸੀ ਅਤੇ ਉਹਦੇ ਵਿੱਚ ਜਿਹੜੇ ਮਰਨ ਵਾਲੇ ਸੀ ਸਾਰੇ ਪੰਜਾਬੀ ਸੀ ਉਸ ਟਾਈਮ ਜਿਹੜਾ ਬ੍ਰਿਟਿਸ਼ ਰਾਜ ਦਾ ਗਵਰਨਰ ਸੀ ਉਹ ਮਾਈਕਲ ਮਾਈਕਲ ਗਵਰਨ ਜੋਰਜ ਮਾਈਕਲ ਸੀਗਾ ਅਤੇ ਜਿਹਨਾਂ ਨੇ ਜਿ ਜਿਸਦਾ ਜਿਹੜਾ ਬਦਲਾ ਸੀ ਉਹ ਕਿਨ ਉਹਨੇ ਦੂਜਾ ਭਗਤ ਸਿੰਘ ਹੋ ਗਿਆ ਰਾਜਗੁਰੂ ਹੋ ਗਿਆ ਇਹਨਾਂ ਨੇ ਉਹਨਾਂ ਦਾ ਬਦਲਾ ਵੀ ਲਿੱਤਾ ਸੀ ਠੀਕ ਹੈ ਉਸ ਤੋਂ ਇਲਾਵਾ ਆਪਾਂ ਜੇ ਗੱਲ ਕਰੀਏ ਤਾਂ ਹੋਰ ਵੀ ਇਹੋ ਜਿਹੀਆਂ ਕਈ ਪਾਰਟੀਆਂ ਵੀ ਬਣੀਆਂ ਪੰਜਾਬ ਦੇ ਵਿੱਚ ਜਿਹਨਾਂ ਨੇ ਪੰਜਾਬ ਦੇ ਜਾਂ ਭਾਰਤ ਦੀ ਆਜ਼ਾਦੀ ਦੇ ਵਿੱਚ ਯੋਗਦਾਨ ਪਾਇਆ ਜਦੋਂ ਭਾਰਤ ਅਤੇ ਪ ਪਾਕਿਸਤਾਨ ਦੀ ਵੰਡ ਵੀ ਹੋਈ ਉਦੋਂ ਵੀ ਜਿਹੜਾ ਸਭ ਤੋਂ ਜ਼ਿਆਦਾ ਦੁੱਖ ਝੇਲਣਾ ਪਿਆ ਉਹ ਪੰਜਾਬ ਨੂੰ ਹੀ ਝੇਲਣਾ ਪਿਆ ਇਸ ਕਰਕੇ ਪੰਜਾਬ ਦਾ ਜਿਹੜੀ ਆਜ਼ਾਦੀ ਜਾਂ ਭਾਰਤ ਦੀ ਆਜ਼ਾਦੀ 'ਚ ਬਹੁਤ ਵੱਡਾ ਰੋਲ ਹੈ